ਹੈਲੋ ਕੌਣ ਜੀ ਹਾਂਜੀ ਹਾਂਜੀ ਤੁਸੀਂ ਬੋਲੋ ਜੀ ਕਿਵੇਂ ਕੀਤਾ ਜੀ ਹਾਂਜੀ ਆਪਣਾ ਫੋਟੋਗਰਾਫੀ ਦਾ ਕੰਮ ਹੈ ਜੀ ਹਾਂਜੀ ਅੱਛਾ ਜੀ ਹਾਂਜੀ ਜਾਗੋ ਦਾ ਪ੍ਰੋਗਰਾਮ ਹੈ ਠੀਕ ਹੈ ਨਹੀਂ ਕਰ ਦਾਂਗੇ ਜੀ ਜਿਵੇਂ ਸਾਰਾ ਪੈਕੇਜ ਮਿਲ ਜਾਊਗਾ ਜੀ ਅੱਛਾ ਪਰੀ ਵੈਡਿੰਗ ਸ਼ੂਟ ਕਰਾਉਣਾ ਜਾਗੋ ਦਾ ਅਤੇ ਮੈਰਿਜ ਦਾ ਨਾਲ ਐਲਬਮ ਫੋਟੋ ਵਾਲੀ ਐਲਬਮ ਬਣਾਉਣੀ ਹੈ ਹੈਂਜੀ ਅੱਛਾ ਅੱਛਾ ਜੀ ਕਰ ਦਿਆਂਗੇ ਜੀ ਸਾਰਾ ਕੰਮ ਕਰ ਦਿਆਂਗੇ ਤੁਹਾਡਾ ਇਹ ਅਲੱਗ ਅਲੱਗ ਪੈਕ ਹੁੰਦੇ ਆ ਜੀ ਮਤਲਬ

ਅੱਛਾ ਜੀ ਆਹ ਮਿਲ ਜੇ ਉਹ ਵੀ ਹੋਜੂ ਜੀ ਐਲਬਮ ਤਿਆਰ ਜੇ ਇੱਕ ਕਹੋ ਇੱਕ ਐਲਬਮ ਬਣਾ ਦਿਆਂਗੇ ਦੋ ਕਹੋਗੇ ਦੋ ਬਣਾ ਦਾਂਗੇ ਜੀ ਬਾਕੀ ਤੁਹਾਨੂੰ ਪੀ ਡੀ ਐਫ ਦੇ ਦਿਆਂਗੇ ਜਿਹੜੀ ਫੋਟੋ ਤੁਸੀਂ ਸਲੈਕਟ ਕਰੋਗੇ ਇੱਕ ਪੀ ਡੀ ਐਫ ਬਣਾ ਕੇ ਦੇ ਦਾਂਗੇ ਉਹੀ ਆਪਾਂ ਉਹ ਲਾ ਦਾਂਗੇ ਜੀ ਜਿੰਨੇ ਪੇਜ ਦੀ ਐਲਬਮ ਬਣੀ ਉਹ ਵਧੀਆ ਕਵਰ ਲਾ ਕੇ ਉਹ ਸਾਨੂੰ ਬਣਾ ਕੇ ਦੇ ਦਾਂਗੇ ਜੀ ਹਾਂ ਬਸ ਨਹੀਂ ਨਹੀਂ ਡਿਜੀਟਲ ਹੀ ਚੱਲਦੀਆਂ ਜੀ ਅੱਜ ਕੱਲ੍ਹ ਉਹ ਇੱਕ ਇੱਕ ਨਹੀਂ ਵਿਦਾਊਟ ਭਰਨ ਵਾਲੀ ਦੇਵਾਂਗੇ ਜੀ ਆਪਾਂ ਤੁਹਾਨੂੰ ਬਣਾ ਕੇ ਵਧੀਆ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਨਾ ਜੀ ਉਹ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਉ ਵਧੀਆ ਬਣਾ ਕੇ ਦੇਵਾਂਗੇ ਹਾਂਜੀ ਪਰੀ ਵੈਡਿੰਗ ਲਈ ਆਪਾਂ ਨੇ ਗਾਹਾਂ ਕੰਟੈਕਟ ਹੁੰਦੇ ਆਪਣੇ ਲੋਕੇਸ਼ਨਾਂ ਕਈ ਤਰ੍ਹਾਂ ਦੇ ਲੋਕੇਸ਼ਨ ਇੱਕ ਤਾਂ ਚੰਡੀਗੜ੍ਹ ਦੇ ਨੇੜੇ ਆ ਜੀ ਇੱਕ ਇੱਧਰ ਬਠਿੰਡਾ ਦੇ ਨੇੜੇ ਹੈਗਾ ਜੀ ਅਤੇ ਇੱਕ ਰੋਪੜ ਜਿਹੜੇ ਤੁਹਾਨੂੰ ਉਹ ਨਾ ਤੁਹਾਨੂੰ ਉਹ ਭੇਜ ਦਾਂਗੇ ਉਹਨਾਂ ਦੀਆਂ ਵੀਡੀਓ ਭੇਜ ਦਿਆਂਗੇ ਜਿਹੜੀ ਤੁਸੀਂ ਪਸੰਦ ਕਹੋਗੇ ਕਰੋਂਗੇ ਆਪਾਂ ਉਹੀ ਪ੍ਰੀ ਵੈਡ ਉੱਥੇ ਹੀ ਕਰਵਾ ਦਾਂਗੇ ਜੀ ਹਾਂ ਹਾਂ ਉਹ ਆਪਣੇ ਜਿਹੜਾ ਰੋਪੜ ਦੇ ਨੇੜੇ ਆ ਨਾ ਜੀ ਉੱਥੇ ਕਰਵਾ ਦਾਂਗੇ ਤੁਹਾਡਾ ਉੱਥੇ ਬਿਲਕੁਲ ਸਿੰਪਲ ਪੇਂਡੂ ਸੱਭਿਆਚਾਰ ਵਾਲਾ ਜਿਵੇਂ ਉਹਦੇ 'ਚ ਝੀਲ ਵਗੈਰਾ ਵੀ ਹੈਗੀ ਪਾਣੀ ਵਾਲਾ ਅਤੇ ਕੱਚਾ ਕੋਠਾ ਦਾ ਘਰ ਜਿਵੇਂ ਪੁਰਾਣੇ ਸਮੇਂ ਦੇ ਚੱਲਦਾ ਸੀ ਜੀ ਉਸ ਤਰ੍ਹਾਂ ਦਾ ਸਾਰਾ ਉੱਥੇ ਹੋ ਜਾਊਗਾ ਪੰਜਾਬੀ ਕਲਚਰ ਜਿਹੜਾ ਸੱਭਿਆਚਾਰ ਪੁਰਾਣਾ ਚਲਦਾ ਸੀ ਉਹ ਸਾਰਾ ਵਿੱਚ ਕਵਰ ਹੋਊਗਾ ਜੀ ਹਾਂ ਉੱਥੇ ਹੀ ਹੋਣਗੀਆਂ ਹਾਂ ਉੱਥੇ ਵੱਡੇ ਉੱਥੇ ਜਿਹੜੀਆਂ ਤੁਸੀਂ ਸਲੈਕਟ ਕਰ ਲਉਂਗੇ ਉਹ ਹੀ ਆਪਾਂ ਵੱਡੇ ਪੋਸਟਰ ਬਣਾ ਦਾਂਗੇ ਅਤੇ ਛੋਟੇ ਪੋਸਟਰ ਵੀ ਬਣ ਜਾਣਗੇ ਵੱਡੇ ਪੋਸਟਰ ਵੀ ਬਣ ਜਾਣਗੇ ਅਤੇ ਆਪਾਂ ਉਹ ਮੈਰਿਜ ਵਗੈਰਾ 'ਚ ਜਿਹੜੇ ਲਗਾਏ ਜਾਂਦੇ ਨੇ ਵੱਡੇ ਪੋਸਟਰ ਬਣਾ ਕੇ ਲਗਾ ਦਾਂਗੇ ਉੱਥੇ ਹਾਂ ਜਿਹੜੇ ਤੁਸੀਂ ਸਿਲੈਕਟ ਕਰ ਲਉਂਗੇ ਨਾ ਜੀ ਉੱਥੇ ਇਹ ਪੈਕੇਜ ਮਤਲਬ ਵਿਦ ਪ੍ਰੀ ਵੈਡ ਸ਼ੂਟ ਅਤੇ ਆਪਣਾ ਐਲਬਮ ਤੁਸੀਂ ਦੋ ਬਣਾਉਂਗੇ ਜੀ ਦੋ ਐਲਬਮਾਂ ਅਤੇ ਇੱਕ ਹਾਂ ਹਾਂ ਇੱਕ ਪੈਨ ਡਰਾਈਵ ਦੇ ਦਿਆਂਗੇ ਤੁਹਾਨੂੰ ਵੀਡੀਓ ਬਣਾ ਕੇ ਸਾਰੇ ਦੀ ਹਾਂ ਇਹ ਸਾਰਾ ਕੁਝ ਹਾਂ ਹਾਂ ਜੀ ਅੱਜ ਕੱਲ੍ਹ ਪਿਨ ਪਿਨ ਡਰਾਈਵ 'ਚ ਦੇ ਦਾਂਗੇ ਜੀ ਤੁਹਾਨੂੰ ਸਾਰਾ ਕੁਝ ਉਹਦੇ 'ਚ ਮਿਕਸਿੰਗ ਕਰਕੇ ਨਾ ਵਿੱਚ ਗੀਤ ਗੂਤ ਲਾ ਕੇ ਸਾਰਾ ਕੁਛ ਨਾ ਮਿਕਸਿੰਗ ਕਰਕੇ ਕਰਕੇ ਤੁਹਾਨੂੰ ਪੈਨ ਡਰਾਈਵ 'ਚ ਦੇ ਦਾਂਗੇ ਅਤੇ ਉਹ ਕਾਪੀ ਜਦੋਂ ਮਰਜ਼ੀ ਤੁਸੀਂ ਹੋਰ ਪੈਨ ਡਰਾਈਵ 'ਚ ਕਰ ਲਓ ਚਾਹੇ ਅਤੇ ਸਾਡੇ ਕੋਲ ਇਹ ਵੀ ਆਪਾਂ ਪੂਰੇ ਵਿਆਹ ਦਾ ਪੈਕੇਜ ਹੀ ਆਊਗਾ ਜੀ ਸਾਰੇ ਦਾ ਹਾਂ ਇਹ ਸਾਰਾ ਕੁਝ ਮਿਕਸ ਆਪਣਾ ਲਗਭਗ ਅੱਸੀ ਹਜ਼ਾਰ ਰੁਪਈਆਂ ਦਾ ਟੋਟਲ ਖਰਚਾ ਆਜੂ ਜੀ ਆਪਣਾ ਵਿਦ ਪ੍ਰੀ ਵੈਡ ਸ਼ੂਟ ਅਤੇ ਵਿੱਚ ਨਾਲ ਇਹਦੇ ਆਪਾਂ ਦੋ ਐਲਬਮਾਂ ਬਣਾਵਾਂਗੇ ਜੀ ਅਤੇ ਜਿਹਦੇ ਵਿੱਚ ਲਗਭਗ ਤੀਹ ਤੀਹ ਪੇਜ ਹੋਣਗੇ ਇੱਕ ਪੇਜ 'ਤੇ ਪੰਜ ਪੰਜ ਛੇ ਛੇ ਫੋਟੋਆਂ ਆ ਜਾਂਦੀਆਂ ਜੀ ਅਤੇ ਨਾਲ ਆਪਣੇ ਤਿੰਨ ਸਾਢੇ ਤਿੰਨ ਘੰਟੇ ਦੀ ਵੀਡੀਓ ਬਣ ਜਾਊਗੀ ਜੀ ਮੂਵੀ ਲਗਭਗ ਅੱਸੀ ਕੁ ਹਜ਼ਾਰ ਰੁਪਏ ਦਾ ਹੋ ਜਾਊਗਾ ਜੇ ਕੋਈ ਹੋਇਆ ਗੁੰਜਾਇਸ਼ ਹੋਉ ਆਪਾਂ ਕੱਢ ਲਾਂਗੇ ਜੀ ਕੋਈ ਨਹੀਂ ਬੈਠ ਕੇ ਆਪਾਂ ਦੁਕਾਨ ਹਾਂਜੀ ਹਾਂਜੀ ਜਦੋਂ ਮਰਜ਼ੀ ਆਇਉ ਜੀ ਆਪਣੀ ਸ਼ੋਪ ਬਰਨਾਲੇ ਆ ਜੀ ਹੰਡਿਆਏ ਬਜ਼ਾਰ ਦੇ ਵਿੱਚ ਹਾਂ ਬਰਨਾਲੇ ਹੰਡਿਆਏ ਬਜ਼ਾਰ ਦੇ ਵਿੱਚ ਜਦੋਂ ਮਰਜ਼ੀ ਪਤਾ ਕਰਕੇ ਨਾ ਆਪਣੀ ਦੁਕਾਨ ਦੇ ਨਾਲ ਫੋਨ ਕਰਕੇ ਆ ਜਿਓ ਅਤੇ ਤੁਹਾਡੇ ਨਾਲ ਵਧੀਆ ਜੋ ਵੀ ਹੈ ਤੁਹਾਨੂੰ ਸੈਂਪਲ ਦਿਖਾ ਦਾਂਗੇ ਹਰ ਤਰ੍ਹਾਂ ਦੇ ਤੁਹਾਨੂੰ ਐਲਬਮ ਦੇ ਸੈਂਪਲ ਵੀ ਦਿਖਾ ਦਾਂਗੇ ਵੀਡੀਓ ਦੇ ਸੈਂਪਲ ਵੀ ਦਿਖਾ ਦਾਂਗੇ ਜਿਹੜੇ ਪੋਸਟਰ ਬਣਾਉਣੇ ਆ ਵੱਡੇ ਅਸੀਂ ਉਹਦੇ ਸੈਂਪਲ ਵੀ ਦਿਖਾ ਦਾਂਗੇ ਜੋ ਤੁਹਾਨੂੰ ਲੋਕੇਸ਼ਨ ਅਸੀਂ ਦੱਸ ਰਹੇ ਆ ਜਿੱਥੇ ਦੀ ਕਰਾਉਣ ਦੀ ਸੋਚ ਰਹੇ ਹਾਂ ਉਹ ਲੋਕੇਸ਼ਨਾਂ ਵੀ ਤੁਹਾਨੂੰ ਸਾਰੀਆਂ ਕੰਪਿਊਟਰ 'ਤੇ ਦਿਖਾ ਦਾਂਗੇ ਅਤੇ ਜਿਹੜੀ ਤੁਸੀਂ ਪਸੰਦ ਕਰੋਗੇ ਉੱਥੇ ਹੀ ਆਪਾਂ ਪ੍ਰੀ ਵੈਡ ਸ਼ੂਟ ਕਰਾ ਦਾਂਗੇ